ਅੱਜ ਦੇ ਸਮੇਂ ਵਿੱਚ ਮੇਰਾ ਮਨਪਸੰਦ ਪਕਵਾਨ ਜੋ ਹੈ ਉਹ ਕੜੀ ਪੰਜਾਬੀ ਕੜੀ ਪਕੌੜਾ ਅਤੇ ਜੀਰਾ ਰਾਈਸ ਹੈ ਬਚਪਨ ਦੇ ਸਮੇਂ ਵਿੱਚ ਜਦੋਂ ਮੈਨੂੰ ਕੁਛ ਜ਼ਿਆਦਾ ਪਸੰਦ ਨਹੀਂ ਸੀ ਅਤੇ ਇਸ ਲਈ ਮੈਂ ਇਹ ਖਾਣਾ ਪਸੰਦ ਨਹੀਂ ਕਰਦੀ ਸੀ ਬਟ ਜਦੋਂ ਮੈਂ ਕਾਲਜ ਦੇ ਸਮੇਂ ਦੇ ਵਿੱਚ ਬਾਹਰ ਪੜ੍ਹਨ ਜਾਂਦੀ ਸੀ ਤਾਂ ਮੈਨੂੰ ਉੱਥੋਂ ਦਾ ਖਾਣਾ ਖਾ ਖਾ ਕੇ ਬੋਰ ਹੋ ਚੁੱਕੀ ਸੀ ਅਤੇ ਫਿਰ ਜਦੋਂ ਵੀ ਅਸੀਂ ਘਰ ਵਾਪਿਸ ਆਉਂਦੇ ਸਨ ਤਾਂ ਸਾਡੀ ਮੰਮੀ ਜੀ ਇਹ ਖਾਣਾ ਬਹੁਤ ਹੀ ਚਾਅ ਨਾਲ ਬਣਾਉਂਦੇ ਸਨ ਅਤੇ ਇਹ ਖਾਣਾ ਬਾਹਰੋਂ ਖਾਣਾ ਖਾ ਖਾ ਕੇ ਅਸੀਂ ਇੰਨੇ ਉੱਕ ਚੁੱਕੇ ਸੀ ਕਿ ਸਾਨੂੰ ਘਰ ਦਾ ਹਰ ਬਣਿਆ ਖਾਣਾ ਬਹੁਤ ਹੀ ਪਸੰਦ ਆਉਂਦਾ ਸੀ ਅਤੇ ਇਹ ਖਾਣਾ ਮੈਨੂੰ ਬਹੁਤ ਹੀ ਜ਼ਿਆਦਾ ਪਸੰਦ ਆਉਣ ਲੱਗ ਪਿਆ ਅਤੇ ਇਸ ਕੜੀ ਪਕੌੜੇ ਦੇ ਪਕੌੜੇ ਮੈਨੂੰ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਨੇ ਅਤੇ ਜੀਰਾ ਰਾਈਜ਼ ਬਹੁਤ ਹੀ ਸੋਫਟ ਹੁੰਦੇ ਹਨ ਅਤੇ ਮੇਰੇ ਮੰਮਾ ਜੀ ਇਸਨੂੰ ਬਹੁਤ ਹੀ ਜ਼ਿਆਦਾ ਤਰੀਕੇ ਨਾਲ ਵਧੀਆ ਤਰੀਕੇ ਨਾਲ ਬਣਾਉਂਦੇ ਹਨ ਜਦੋਂ ਵੀ ਮੈਂ ਆਫਿਸ ਦੇ ਵਿੱਚ ਜਾਂਦੀ ਸੀ ਤਾਂ ਮੇਰੇ ਕਲੀਗ ਸੀ ਜੋ ਮੇਰੇ ਨਾਲ ਹੁੰਦੇ ਸਨ ਉਹ ਵੀ ਇਸਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਸਨ ਅਤੇ ਹੁਣ ਇਹ ਮੇਰਾ ਇੰਨਾਂ ਜ਼ਿਆਦਾ ਫੇਵਰੇਟ ਪਕਵਾਨ ਬਣ ਚੁੱਕਿਆ ਹੈ ਕਿ ਮੈਂ ਇਹਨੂੰ ਹਫਤੇ ਦੇ ਵਿੱਚ ਇੱਕ ਵਾਰ ਜ਼ਰੂਰ ਖਾਣਾ ਪਸੰਦ ਕਰਦੀ ਹਾਂ ਅਤੇ ਇਸ ਨੂੰ ਖਾ ਕੇ ਮੈਨੂੰ ਆਪਣਾ ਬਚਪਨ ਯਾਦ ਆ ਜਾਂਦਾ ਹੈ ਜਦੋਂ ਕਿ ਮੈਂ ਇਸਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੀ ਸੀ ਅਤੇ ਸੋਚਦੀ ਹੁੰਦੀ ਸੀ ਕਿ ਇਸ ਨੂੰ ਲੋਕ ਕਿਵੇਂ ਖਾਂਦੇ ਨੇ ਅਤੇ ਹੁਣ ਇਸਨੂੰ ਖਾ ਕੇ ਮੈਨੂੰ ਇੰਨੀ ਜ਼ਿਆਦਾ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਧੰਨਵਾਦ